ਮੇਰੀ ਮਨਪਸੰਦ ਭਾਸ਼ਾ ਪੰਜਾਬੀ ਹੈ ਕਿਉਂਕਿ ਮੈਂ ਸ਼ੁਰੂ ਤੋਂ ਹੀ ਪੰਜਾਬ ਵਿੱਚ ਰਹਿੰਦੀ ਹਾਂ ਪੰਜਾਬ ਦੇ ਜ਼ਿਲ੍ਹੇ ਪਟਿਆਲੇ ਵਿੱਚ ਹੀ ਰਹਿੰਦੀ ਹਾਂ ਮੇਰੇ ਆਲੇ ਦੁਆਲੇ ਅਤੇ ਮੇਰੇ ਮਾਤਾ ਪਿਤਾ ਸਾਰੇ ਪੰਜਾਬੀ ਹੀ ਬੋਲਦੇ ਹਨ ਅਤੇ ਮੈਂ ਸਕੂਲ ਵਿੱਚ ਜਦ ਦਾਖ਼ਲਾ ਲਿਆ ਤਾਂ ਸ਼ੁਰੂ ਤੋਂ ਹੀ ਮੈਨੂੰ ਪੰਜਾਬੀ ਪੜ੍ਹਾਈ ਗਈ ਪਹਿਲਾਂ ਮੈਨੂੰ ਇਹ ਔਖੀ ਲੱਗਦੀ ਸੀ ਅਤੇ ਪਰ ਮੇਰੇ ਅਧਿਆਪਕਾਂ ਨੇ ਮੇਰੀ ਮਦਦ ਕੀਤੀ ਅਤੇ ਪੰਜਾਬੀ ਮੈਨੂੰ ਬੋਲਣੀ ਸਿਖਾਈ ਅਤੇ ਲਿਖਣੀ ਵੀ ਸਿਖਾਈ ਅਤੇ ਸਾਰੇ ਬੱਚਿਆਂ ਨੂੰ ਵੀ ਮੇਰੇ ਨਾਲ ਜਿਹੜੇ ਪੜ੍ਹਦੇ ਸਾਰੇ ਪੰਜਾਬੀ ਹੀ ਸਿੱਖਦੇ ਸਨ ਜੋ ਕਿ ਬਹੁਤ ਹੀ ਵਧੀਆ ਭਾਸ਼ਾ ਹੈ ਅੱਜ ਕੱਲ੍ਹ ਦੇ ਸਮਿਆਂ ਵਿੱਚ ਸਾਰੇ ਨੌਜਵਾ ਨੌਜਵਾਨ ਸਾਰੇ ਅੱਜ ਅੰਗਰੇਜ਼ੀ ਵੱਲ ਵੱਧ ਰਹੇ ਹਨ ਜੋ ਕਿ ਇਹ ਬਹੁਤ ਹੀ ਵਧੀਆ ਗੱਲ ਨਹੀਂ ਹੈ ਕਿਉਂਕਿ ਪੰਜਾਬੀ ਹੀ ਸਾਡੀ ਮਾਤਰ ਭਾਸ਼ਾ ਹੀ ਮਾਂ ਬੋਲੀ ਹੈ ਅਤੇ ਵੱਧ ਤੋਂ ਵੱਧ ਸਾਰਿਆਂ ਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ ਅਤੇ ਮੈਨੂੰ ਪੰਜਾਬੀ ਹੋਣ 'ਤੇ ਮਾਣ ਹੈ